ਪੰਜਾਬੀ ਭਾਸ਼ਾ ਇੱਕ ਬਹੁਤ ਖਿੱਤੇ ਵਿੱਚ ਬੋਲੇ ਜਾਣ ਵਾਲੀ ਭਾਸ਼ਾ ਹੈ ਇਹ ਭਾਸ਼ਾ ਬਹੁਤ ਹੀ ਬਹੁਤ ਜ਼ਿਆਦਾ ਖਿੱਤਿਆਂ ਵਿੱਚ ਅਤੇ ਕਈ ਮੁਲਕਾਂ ਵਿੱਚ ਵੀ ਬੋਲੀ ਜਾਂਦੀ ਹੈ ਜਿਵੇਂ ਕਿ ਪਾਕਿਸਤਾਨ ਦੇ ਕ ਕਾਫ਼ੀ ਵੱਡੇ ਹਿੱਸੇ ਦੀ ਭਾਸ਼ਾ ਪੰਜਾਬੀ ਹੀ ਹੈ ਅਤੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਕਈ ਇਲਾਕਿਆਂ ਦੀ ਭਾਸ਼ਾ ਵੀ ਪੰਜਾਬੀ ਹੀ ਹੈ ਪਰ ਪੰਜਾਬੀ ਨੇ ਹੋਰ ਭਾਸ਼ਾਵਾਂ ਦੇ ਵਿਕਾਸ ਨੂੰ ਪ੍ਰਭਾਵਿਤ ਬਹੁਤਾ ਜ਼ਿਆਦਾ ਨਹੀਂ ਕੀਤਾ ਹੈ ਕਿਉਂਕਿ ਪੰਜਾਬ ਦੇ ਵਿੱਚ ਬਹੁਤਾਤ ਲੋਕ ਪੰਜਾਬੀ ਦੇ ਨਾਲ ਨਾਲ ਹਿੰਦੀ ਵੀ ਬੋਲ ਲੈਂਦੇ ਹਨ ਅਤੇ ਸਮਝ ਲੈਂਦੇ ਹਨ ਪੰਜਾਬੀ ਭਾਸ਼ਾ ਜਿਹੜੀ ਹੈ ਉਹ ਹਿੰਦੀ ਅਤੇ ਉੜਦੂ ਦੇ ਨਾਲ ਕਾਫ਼ੀ ਮੇਲ ਅਤੇ ਸੁਮੇਲ ਖਾਂਦੀ ਹੈ ਕਈ ਲਫ਼ਜ਼ ਅਤੇ ਕਈ ਅਲਫਾਜ਼ ਪੰਜਾਬੀ ਦੇ ਹਿੰਦੀ ਅਤੇ ਉੜਦੂ ਦੇ ਵਿੱਚੋਂ ਹੀ ਲਏ ਗਏ ਹਨ ਅਤੇ ਕਈ ਕਾਫ਼ੀ ਬੋਲਣ ਦੇ ਵਿੱਚ ਬਣਤਰ ਦੇ ਵਿੱਚ ਅਤੇ ਇਹਦੀ ਲਿਖਾਵਟ ਦੇ ਵਿੱਚ ਬਹੁਤ ਸਾਰੇ ਜਿਹੜੇ ਅੱਖਰ ਅਤੇ ਬੋਲਣ ਦੇ ਵਿੱਚ ਜਿਹੜੀ ਅੱਖਰਾਂ ਦੀ ਬਣਤਰ ਹੈ ਉਹ ਸਾਰੀ ਹੀ ਹਿੰਦੀ ਜਾਂ ਉੜਦੂ ਦੇ ਤਰ੍ਹਾਂ ਹੀ ਪੰਜਾਬੀ ਦੀ ਕੀਤੀ ਜਾਂਦੀ ਹੈ ਪੰਜਾਬੀ ਭਾਸ਼ਾ ਕਈ ਉੱਪਰਲੇ ਪਹਾੜੀ ਰਾਜਿਆਂ ਰਾਜਾ ਦੇ ਵਿੱਚ ਵੀ ਬੋਲੀ ਜਾਂਦੀ ਹੈ ਜਿੱਥੇ ਕਿ ਕੁਛ ਉੱਥੇ ਦੀਆਂ ਲੋਕਲ ਭਾਸ਼ਾਵਾਂ ਹਨ ਜਿਨ੍ਹਾਂ ਦੇ ਥੋੜ੍ਹਾ ਜਿਹਾ ਵਿਕਾਸ ਦੇ ਉੱਤੇ ਅਸ ਅਸਰ ਪਿਆ ਹੈ ਕਿਉਂਕਿ ਉਹ ਭਾਸ਼ਾਵਾਂ ਲਿਖਤੀ ਰੂਪ ਵਿੱਚ ਨਹੀਂ ਸਨ ਉਹ ਸਿਰਫ਼ ਬੋਲਣ ਦੇ ਵਿੱਚ ਸਨ ਇਸ ਕਰਕੇ ਉਹਨਾਂ ਭਾਸ਼ਾਵਾਂ ਦੇ ਜਿਹੜਾ ਵਿਕਾਸ ਸੀ ਉਹ ਥੋੜ੍ਹਾ ਜਿਹਾ ਰੁਕ ਗਿਆ ਅਤੇ ਉੱਥੇ ਪੰਜਾਬੀ ਨੇ ਆਪਣੇ ਆਪ ਨੂੰ ਉੱਪਰ ਕਰ ਲਿਆ ਪੰਜਾਬੀ ਉੱਥੇ ਲਿਖਣ ਬੋਲਣ ਦੇ ਵਿੱਚ ਆ ਗਈ ਇਸ ਕਰਕੇ ਪੰਜਾਬੀ ਭਾਸ਼ਾ ਨੇ ਉਹਨਾਂ ਭਾਸ਼ਾਵਾਂ ਨੂੰ ਥੋੜ੍ਹਾ ਜਿਹਾ ਪ੍ਰਭਾਵਿਤ ਕੀਤਾ ਹੈ